ਜੇਕਰ ਸਨਾਥਨਕ ਕਲਾਕਾਰਾਂ ਬਾਰੇ ਗੱਲ ਕੀਤੀ ਜਾਏ ਤਾਂ ਸਾਡੇ ਅ ਦੇਸ਼ ਦੇ ਭਾਈਚਾਰੇ ਵੀ ਬੜੇ ਵਧੀਆ ਹਨ ਸਾਰੇ ਇਕੱਠੇ ਸੰਗਠਨ ਕਰਕੇ ਸਾਰੇ ਕੰਮ ਕਰਦੇ ਹਨ ਸਮਾਜ ਵਿੱਚ ਵੀ ਬੜਾ ਇਕੱਠ ਰੱਖਿਆ ਗਿਆ ਹੈ ਨੈਟਵਰਕ ਦੀ ਜੇ ਗੱਲ ਕਰਿਆ ਜਾਏ ਤਾਂ ਨੈਟਵਰਕ ਦੀ ਵੀ ਇੱਥੇ ਬੜੀ ਵਧੀਆ ਉਹ ਦਿੱਤੀ ਜਾ ਰਹੀ ਹੈ ਜਿਸ ਕਰਕੇ ਕਿ ਬਹੁਤ ਵਧੀਆ ਭਾਈਚਾਰਾ ਬਣਿਆ ਹੋਇਆ ਹੈ ਇੱਥੇ ਲੋਕ ਇਕੱਠੇ ਸਾਰੇ ਅ ਗੱਲ ਕਰਕੇ ਇੱਥੇ ਇੱਕ ਕਰਕੇ ਭਾਈਚਾਰਾ ਰੱਖਦੇ ਹਨ ਹਰ ਗੱਲ ਵਿੱਚ ਇੱਕ ਦੂਜੇ ਦੀ ਸਾਂਝ ਸਬੰਧੀ ਰੱਖ ਕੇ ਫਿਰ ਹੀ ਆਪਣੇ ਅੱਗੇ ਭਾਈਚਾਰੇ ਨੂੰ ਚਲਾਉਂਦੇ ਹਨ ਸਮਾਜ ਦੀ ਜੇ ਗੱਲ ਕੀਤੀ ਜਾਏ ਤਾਂ ਸਮਾ ਇੱਥੇ ਸਮਾਜ ਵਿੱਚ ਬੜਾ ਜ਼ਿਆਦਾ ਇੱਕ ਦੂਸਰੇ ਨਾਲ ਸਮੂਹ ਪ੍ਰੇਮ ਪਿਆਰ ਰੱਖਦੇ ਹਨ ਜਿਸ ਕਰਕੇ ਸਾਡੇ ਦੇਸ਼ ਦੀ ਵੀ ਬੁਨਿਆਦ ਅੱਜ ਤੱਕ ਬਣੀ ਹੋਈ ਹੈ ਅਤੇ ਜਿਸ ਕਰਕੇ ਸਾਰੇ ਸੰਗਠਨ ਕਰਕੇ ਇਕੱਠੇ ਰਹਿ ਕੇ ਸਾਰੇ ਸ ਗੱਲ ਸ ਬਾਤ ਕਰਕੇ ਇੱਕ ਫੈਸਲਾ ਲੈਂਦੇ ਹਨ ਸਾਡੇ ਨੈਟਵਰਕ ਵਿੱਚ ਵੀ ਕੋਈ ਅੱਜ ਤੱਕ ਦੀ ਜਿਹੜੀ ਵੀ ਹਰ ਗੱਲਬਾਤ ਹੈ ਵਧੀਆ ਹੋ ਰਹੀ ਹੈ ਨੈਟਵਰਕ ਪ੍ਰੋਬਲਮ ਵੀ ਇੱਥੇ ਘੱਟ ਚੱਲ ਰਹੀ ਹੈ ਜਿਸ ਕਰਕੇ ਕਿ ਸਮਾਜ ਵਿੱਚ ਕੋਈ ਸਾਨੂੰ ਤੰਗੀ ਨਾ ਹੋਵੇ ਇਸ ਕਰਕੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ